ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਤੁਸੀਂ ਸਵੀਗੀ ਤੋਂ ਗੁਪਤਾ ਰੈਸਟੋਰੈਂਟ ਤੋਂ ਬੋਲਦੇ ਪਏ ਹੋ ਹਾਂਜੀ ਮੈਂ ਨਾ ਕੁਛ ਭੋਜਨ ਔਡਰ ਕੀਤਾ ਸੀ ਦਸ ਮਿੰਟ ਪਹਿਲਾਂ ਹੀ ਹੋਇਆ ਮੈਨੂੰ ਔਰਡਰ ਕੀਤੇ ਹੋਏ ਹਾਂਜੀ ਅਤੇ ਮੈਂ ਨਾ ਮਠਿਆਈਆਂ ਵੀ ਸ਼ਾਮਿਲ ਕਰਨੀਆਂ ਸੀ ਪਰ ਮੈਨੂੰ ਯਾਦ ਭੁੱਲ ਗਿਆ ਮੈਂ ਸ਼ਾਮਿਲ ਕਰ ਸਕਦੀ ਹਾਂ ਅੱਛਾ ਫਿਰ ਤੋਂ ਔਡਰ ਕਰਨਾ ਪਵੇਗਾ ਬੇਨਤੀ ਹੈ ਕਿ ਇਸ ਵਿੱਚ ਹੀ ਸ਼ਾਮਿਲ ਕਰ ਦਿਓ ਜਿੱਦਾਂ ਆਈਸਕ੍ਰੀਮ ਵੀ ਮੰਗਵਾਉਣੀ ਸੀ ਕੇਕ ਵੀ ਇੱਕ ਹਲਵਾ ਇਹ ਸਭ ਵਿੱਚ ਸ਼ਾਮਲ ਕਰ ਦਿਓ ਹਾਂਜੀ ਹਾਂਜੀ ਹਾਂਜੀ ਰੰਜਨਾ ਕੁੰਡ ਨਾਮ 'ਤੇ ਹੀ ਮੇਰੀ ਆਈ ਡੀ ਆ ਹਾਂਜੀ ਅਤੇ ਇਹਦਾ ਔਡਰ ਆਈ ਡੀ ਆ ਵਨ ਟੂ ਥਰੀ ਐਟ ਦੀ ਰੇਟ ਰੰਜਨਾ ਕੁੰਡਲ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਕਿੰਨੇ ਕੁ ਟਾਈਮ ਤੱਕ ਪਹੁੰਚ ਜਾਵੇਗਾ ਅੱਛਾ ਅੱਧਾ ਘੰਟਾ ਲੱਗ ਜਾਵੇਗਾ ਕੋਈ ਨਹੀਂ ਕੋਈ ਨਹੀਂ ਤੁਸੀਂ ਪਹੁੰਚਾ ਦਿਓ ਹਾਂਜੀ ਹਾਂਜੀ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਪਹੁੰਚਾ ਦਿਓ ਕੋਈ ਨਾ ਬਹੁਤ ਬਹੁਤ ਧੰਨਵਾਦ ਜੀ